ਪੰਜਾਬ ਦੇ ਹੈਂਡੀਕ੍ਰਾਫਟਸ ਦੇ ਵਿੱਚ ਮੰਜੇ ਬੁਣਨੇ ਪੀੜੀਆਂ ਬੁਣਨੀਆਂ ਪਰਾਂਦੇ ਬਣਾਣੇ ਮਿੱਟੀ ਦੇ ਖਿਡੌਣੇ ਯਾ ਫਿਰ ਮਿੱਟੀ ਦੇ ਦੀਵੇ ਬਣਾਉਣੇ ਇੱਦਾਂ ਦੀਆਂ ਬਹੁਤ ਸਾਰੀਆਂ ਚੀਜ਼ਾਂ ਜੋ ਨੇ ਉਹ ਆਉਂਦੀਆਂ ਨੇ ਸਮੇਂ ਦੇ ਨਾਲ਼ ਨਾਲ਼ ਲੋਕੀ ਜੋ ਨੇ ਉਹ ਇਹਨਾਂ ਕਲਾਵਾਂ ਨੂੰ ਭੁੱਲਦੇ ਜਾ ਰਹੇ ਨੇ ਪਹਿਲੇ ਸਮੇਂ ਦੇ ਵਿੱਚ ਸਾਰੀਆਂ ਚੀਜ਼ਾਂ ਹੱਥਾਂ ਨਾਲ਼ ਏ ਬਣਾਈਆਂ ਜਾਂਦੀਆਂ ਸਨ ਜਿਵੇਂ ਕਿ ਕਢਾਈ ਕੱਢਣੀ ਯਾ ਫਿਰ ਫੁੱਲਕਾਰੀ ਬਣਾਉਣੀ ਇਹ ਸਾਰਾ ਕੁਝ ਵੀ ਹੈਂਡੀਕ੍ਰਾਫਟ ਦੇ ਵਿੱਚ ਹੀ ਆਉਂਦਾ ਹੈ ਬਟ ਅੱਜ ਕੱਲ੍ਹ ਜਿਵੇਂ ਕਿ ਟੈਕਨੋਲਜੀ ਜਾਂ ਜੋ ਹੈ ਉਹ ਵੱਧ ਗਈ ਹੈ ਤਾਂ ਇਹ ਸਾਰਾ ਕੁਝ ਜੋ ਹੈ ਉਹ ਮਸ਼ੀਨਾਂ ਦੇ ਨਾਲ਼ ਹੀ ਬਣ ਜਾਂਦਾ ਹੈ ਜਿਸ ਨਾਲ਼ ਜੋ ਹੈਂਡੀਕ੍ਰਾਫਟਸ ਹੈ ਉਸ ਦੀ ਪ੍ਰਸਿੱਧਤਾ ਜੋ ਹੈ ਉਹ ਘੱਟਦੀ ਜਾ ਰਹੀ ਹੈ ਬਟ ਬਹੁਤ ਸਾਰੇ ਇੱਦਾਂ ਦੇ ਇੰਸਟੀਟਿਊਸ਼ਨ ਨੇ ਬਹੁਤ ਸਾਰੀਆਂ ਐਗਜੀਵੀਸ਼ਨਜ ਹੁੰਦੀਆਂ ਨੇ ਜਿਸ ਨਾਲ਼ ਇਹਨੂੰ ਪ੍ਰਮੋਟ ਕਰਨ ਦੀ ਕੋਸ਼ਿਸ਼ ਕੀਤੀ ਜਾਂਦੀ ਹੈ ਹੈਂਡੀਕ੍ਰਾਫਟ ਇੰਨਡਸਟਰੀ ਜੋ ਹੈ ਉਹ ਇੱਕ ਬਹੁਤ ਹੀ ਫੇਮਸ ਇੰਨਡਸਟਰੀ ਹੈ ਅਤੇ ਇਹ ਆਰਟਿਸਟ ਜੋ ਹੈ ਉਹਦੀ ਕਲਾ ਨੂੰ ਦਰਸ਼ਾਉਣ ਦਾ ਇੱਕ ਬਹੁਤ ਹੀ ਚੰਗਾ ਤਰੀਕਾ ਹੈ ਜਿਵੇਂ ਕਿ ਹੁਣ ਦਿਵਾਲੀ ਆ ਰਹੀ ਹੈ ਤਾਂ ਅਲੱਗ ਅਲੱਗ ਤਰ੍ਹਾਂ ਦੇ ਮਿੱਟੀ ਦੇ ਦੀਵੇ ਅਤੇ ਹੋਰ ਵੀ ਸਜਾਵਟ ਵਾਲੀਆਂ ਚੀਜ਼ਾਂ ਹੱਥਾਂ ਨਾਲ਼ ਬਣੀਆ ਹੋਈਆਂ ਜੋ ਨੇ ਉਹ ਬਜ਼ਾਰ ਵਿੱਚ ਵਿਕਣ ਗੀਆਂ ਅਤੇ ਸਾਨੂੰ ਵੀ ਉਹਨਾਂ ਚੀਜ਼ਾਂ ਨੂੰ ਖਰੀਦ ਕੇ ਹੈਂਡੀਕ੍ਰਾਫਟ ਨੂੰ ਪ੍ਰਮੋਟ ਕਰਨਾ ਚਾਹੀਦਾ ਹੈ ਆਪਣੇ ਹੈਂਡੀਕ੍ਰਾਫਟ ਨੂੰ ਪ੍ਰਮੋਟ ਕਰਨ ਲਈ ਕੋਲਜਿਸ ਅਤੇ ਇੰਸਟੀਚਿਊਸ਼ਨਜ਼ ਵੀ ਯੂਥ ਫੈਸਟ ਦੇ ਵਿੱਚ ਪਰਾਂਦਾ ਮੈਕਿੰਗ ਖਿਡੌਣੇ ਮੇਕਿੰਗ ਇੱਦਾਂ ਦੀਆਂ ਆਈਟਮਸ ਰੱਖਦੇ ਨੇ ਜਿਸ ਨਾਲ਼ ਜੋ ਪੰਜਾਬ ਦਾ ਕਲਚਰਲ ਹੈਂਡੀਕ੍ਰਾਫਟਸ ਹੈ ਫੁੱਲਕਾਰੀ ਕੱਢਣਾ ਕਢਾਈ ਕੱਢਣਾ ਇਹ ਸਾਰਾ ਜੋ ਹੈ ਇਹ ਆਉਣ ਵਾਲੀ ਪੀੜ੍ਹੀਆਂ ਨੂੰ ਵੀ ਪਤਾ ਲੱਗੇ ਅਤੇ ਬੱਚਿਆਂ ਨੂੰ ਇਸ ਚੀਜ਼ ਦੀ ਨੌਲੇਜ ਹੋਵੇ